ਫਤਿਹਗੜ੍ਹ ਸਾਹਿਬ ਧਾਰਮਿਕ ਅਸਥਾਨ ਬਹੁਤ ਵੱਡਾ ਅਸਥਾਨ ਹੈ ਜੋ ਛੋਟੇ ਸਾਹਿਬਜ਼ਾਦਿਆਂ ਦੇ ਅਤੇ ਮਾਤਾ ਗੁਜਰੀ ਕੌਰ ਜੀ ਦੇ ਸ ਸ਼ਹੀਦਾਂ ਦੇ ਸੰਬੰਧ ਵਿੱਚ ਜਾਣਿਆ ਜਾਂਦਾ ਹੈ ਪਰ ਇੱਥੇ ਕਾਫੀ ਸ਼ਤਾਨੀ ਜਾਂ ਬਾਹਰੋਂ ਲੋਕ ਘੁੰਮਣ ਲਈ ਆਉਂਦੇ ਆ ਅਤੇ ਮੱਥਾ ਟੇਕਣ ਦੇ ਵੀ ਆਉਂਦੇ ਹਨ ਅਤੇ ਇੱਥੇ ਦੇ ਨੇੜੇ ਨੇੜੇ ਹੋਰ ਵੀ ਦੇਖਣਯੋਗ ਸਥਾਨ ਹਨ ਕਿਵੇਂ ਸਾਡੇ ਆਮ ਖਾਸ ਬਾਗ ਹੈ ਜੋ ਮੁਗਲ ਬਾਦਸ਼ਾਹ ਦਾ ਜੀ ਦਾ ਹੈਗਾ ਉਸ ਤੋਂ ਬਾਅਦ ਟੋਡਰ ਮੱਲ ਹਵੇਲੀ ਹੈ ਪਰੇ ਉਹਦੇ ਤੋਂ ਬਾਅਦ ਸਾਡੇ ਚ ਮਾਤਾ ਦਾ ਮੰਦਰ ਵੀ ਹੈ ਉਹ ਨੇੜੇ ਨੇੜੇ ਕਾਫੀ ਕੁਛ ਹੈਗੇ ਐਂ ਜੋ ਘੁੰਮਣ ਫਿਰ ਲਈ ਗੱਡੀ ਦੀ ਸਹਾਇਤਾ ਲਈ ਜਾਂਦੀ ਹੈ ਜਿਸ ਨੂੰ ਕੁਛ ਪੈਸੇ ਲੱਗਦੇ ਕਿਵੇਂ ਪੰਜ ਸੱਤ ਹਜ਼ਾਰ ਰੁਪਇਆ ਲੱਗ ਜਾਂਦਾ ਉਸ ਤੋਂ ਬਾਅਦ ਰੈਸਟੋਰੈਂਟ ਦੇ ਵਿੱਚ ਰਹਿਣ ਲਈ ਦੋ ਦਿਨ ਤਿੰਨ ਦਿਨ ਦਾ ਖਰਚਾ ਪਾ ਕੇ ਟੋਟਲ ਖਰਚਾ ਲਗਭਗ ਦਸ ਤੋਂ ਪੰਦਰ੍ਹਾਂ ਹਜ਼ਾਰ ਦੇ ਵਿੱਚ ਵਿੱਚ ਆ ਜਾਂਦਾ